ਸਾਡੇ ਕੋਲ ਵ ਵਿਹੜੇ ਜਾਂ ਬਾਗ ਵਿੱਚ ਪੰਛੀਆਂ ਨੂੰ ਅਕਰਸ਼ਿਤ ਕਰਨ ਲਈ ਬਹੁਤ ਸੁਝਾਅ ਹਨ ਜਿਵੇਂ ਕਿ ਮੈਂ ਜਦੋਂ ਵੀ ਸਵੇਰੇ ਉੱਠਦਾ ਹਾਂ ਮੇਰਾ ਡੇਲੀ ਦਾ ਰੂਟੀਨ ਆ ਮੋਰਨਿੰਗ ਦਾ ਅਸੀਂ ਆਪਣੇ ਕੋਠੇ 'ਤੇ ਇੱਕ ਕੁੱਜਾ ਰੱਖਿਆ ਹੋਇਆ ਹੈ ਜੋ ਕਿ ਪੰਛੀਆਂ ਲਈ ਹੀ ਰੱਖਿਆ ਹੋਇਆ ਹੈ ਅਤੇ ਮੈਂ ਸਵੇਰੇ ਉੱਠਦੀ ਸਾਰ ਹੀ ਮੋਰਨਿੰਗ ਉਸ ਕੁੱਜੇ ਨੂੰ ਸਾਫ ਕਰਕੇ ਅਤੇ ਪੰਛੀਆਂ ਲਈ ਸਾਫ ਪਾਣੀ ਪਾਉਂਦਾ ਹੈ ਜੇਕਰ ਅਗਰ ਆਪਾਂ ਸਾਫ ਪਾਣੀ ਪੀ ਸਕਦੇ ਹਾਂ ਤਾਂ ਉਹਨਾਂ ਲਈ ਵੀ ਸਾਫ ਪਾਣੀ ਰੱਖ ਸਕਦੇ ਹਾਂ ਅਤੇ ਦੂਜੀ ਗੱਲ ਇਹ ਆ ਕਿ ਮੈਂ ਸਪੈਸ਼ਲ ਉਹਨਾਂ ਪੰਛੀਆਂ ਪਰਿੰਦਿਆਂ ਲਈ ਕਣਕ ਦਾ ਦੈੜ ਕਢਾਇਆ ਹੋਇਆ ਹੈ ਰੋਜ਼ ਇੱਕ ਮੁੱਠੀ ਪਾਉਣ ਨਾਲ ਆਪਣਾ ਇਸ ਵਿੱਚ ਕੁਝ ਨਹੀਂ ਜਾਂਦਾ ਅਤੇ ਮੈਂ ਪੰਛੀਆਂ ਨੂੰ ਆਕਰਸ਼ਿਤ ਕਰਨ ਲਈ ਆਪਣੇ ਕੋਠੇ ਉੱਤੇ ਕਈ ਗਮਲਿਆਂ ਵਿੱਚ ਫਲਾਂ ਵਾਲੇ ਅਤੇ ਫੁੱਲਾਂ ਵਾਲੇ ਬੂਟੇ ਲਗਾਏ ਹੋਏ ਹਨ ਇਸ ਨਾਲ ਮਾਹੌਲ ਹਰਿਆ ਭਰਿਆ ਰਹਿੰਦਾ ਹੈ